ਹੈਲ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਹੈ ਜੀ ਤੁਸੀਂ ਸੁਣਾਉ ਆਪਣਾ ਕੀ ਗੱਲ ਹੈ ਤੁਸੀਂ ਆਏ ਨਹੀਂ ਹੈਗੇ ਕਿੰਨੇ ਦਿਨਾਂ ਤੋਂ ਕੋਈ ਨਾ ਭੈਣ ਹਾਂਜੀ ਹਾਂਜੀ ਹਾਂਜੀ ਘਰ ਹਾਂ ਜੀ ਆ ਜਾਉ ਜੀ ਹਾਂਜੀ ਹਾਂਜੀ ਜ਼ਰੂਰ ਜੀ ਅੱਜ ਕੱਲ੍ਹ ਭੈਣ ਜੀ ਵਧੀਆ ਚੱਲਦਾ ਪਿਓਰ ਦਾ ਸੂਟ ਵੀ ਅੱਛੇ ਆ ਕੋਟਨ ਵਿੱਚ ਵੀ ਬੜੇ ਅੱਛੇ ਅੱਛੇ ਆਉਂਦੇ ਹੈ ਹਾਂਜੀ ਲੈ ਆਇਓ ਡਿਜ਼ਾਈਨਿੰਗ ਬਹੁਤ ਡਿਜ਼ਾਈਨਿੰਗ ਵੀ ਬਹੁਤ ਅੱਛੀਆਂ ਹਾਂਜੀ ਹਾਂਜੀ ਕਲਰ ਵਾਈਨ ਵਗੈਰਾ ਦਾ ਵੀ ਅੱਛਾ ਰਹੂ ਆ ਗਿਆ ਵਾਈਨ ਕਲਰ ਲੈ ਲਿਓ ਪਿੰਕ ਲੈ ਲਿਓ ਪੀਚ ਲੈ ਲਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਭੈਣ ਜੀ ਲੈ ਲਿਓ ਚਾਰ ਪੰਜ ਕੁ ਦਿਨ ਲੱਗੂਗੇ ਫੁੱਲ ਪਟਿਆਲਾ ਨੂੰ ਸਾਢੇ ਤਿੰਨ ਮੀਟਰ ਲੱਗੂਗਾ ਜੀ ਹਾਂਜੀ ਲਾਈਨਿੰਗ ਹਾਂਜੀ ਹਾਂਜੀ ਸਭ ਨੂੰ ਲਾ ਦੂੰਗੇ ਲਾ ਦੂੰਗੇ ਜੀ ਹਾਂਜੀ ਹਾਂਜੀ ਲਗਾ ਦੂੰਗੇ ਭੈਣ ਜੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਹਾਂਜੀ ਹਾਂਜੀ ਲੈ ਆਇਓ ਠੀਕ ਤੁਸੀਂ ਆ ਜਿਓ ਜੀ ਹੁਣ ਚਾਹੇ ਦਿਨ ਮੇ ਦੋ ਢਾਈ ਵਜੇ ਆ ਜਿਓ ਹਾਂਜੀ ਹਾਂਜੀ ਠੀਕ ਹੈ ਭੈਣ ਜੀ ਆ ਜਿਓ ਆ ਜਿਓ ਘਰੇ ਹੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ